ਹਾਂਜੀ ਅਸੀਂ ਸਰਕਾਰੀ ਐਪ ਜਿਹੜੀ ਕੋਵਾ ਐਪ ਸੀ ਉਹ ਵੀ ਯੂਜ਼ ਕੀਤੀ ਹੈ ਜੀ ਉਹਦੇ ਵਿੱਚ ਲੋਕਾਂ ਨੂੰ ਕੋਵਿਡ ਬਾਰੇ ਜਾਗਰੂਕ ਕਰਨਾ ਸੀ ਅਤੇ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਾਈ ਜਾਵੇ ਅਤੇ ਕੋਵਿਡ ਤੋਂ ਬਚਿਆ ਜਾਵੇ ਅਤੇ ਇੱਕ ਹੈਗੀ ਹੈ ਸਰਕਾਰੀ ਐਪ ਪੋਸ਼ਨ ਟਰੈਕਰ ਜਿਸ 'ਤੇ ਸਾਰੇ ਬੈਨੀਫਿਸ਼ਲੀ ਜਿਹੜੇ ਹੈਗੇ ਹਨ ਜ਼ੀਰੋ ਟੂ ਸਿਕਸ ਮੰਨਥ ਪ੍ਰੈਗਨੈਂਟ ਨਰਸਿੰਗ ਅਤੇ ਉਹਨਾਂ ਦਾ ਸਾਰਾ ਹੀ ਡਾਟਾ ਭਰਿਆ ਜਾਂਦਾ ਹੈਲਥ ਰਿ ਰਿਲੇਟਿਡ ਅਤੇ ਨਿਊਟ੍ਰੇਸ਼ਨ ਦਾ ਵੇਟ ਹਾਈਟ ਦਾ ਪੂਰਾ ਹੀ ਜਿਹੜਾ ਰਿਕਾਰਡ ਹੈ ਪੋ ਪੋਸ਼ਨ ਟਰੈਕਰ 'ਤੇ ਅਪਲੋਡ ਕੀਤਾ ਜਾਂਦਾ ਹੈ